ਹੈਲੋ ਹਾਂਜੀ ਸਰ ਇਹ ਸਰਕਾਰੀ ਚੋਂ ਸਰਕਾਰੀ ਸਕੂਲ ਚੋਂ ਬਲਜੀਤ ਸਿੰਘ ਬੋਲ ਰਹੇ ਹੋ ਹਾਂ ਸਰ ਮੈਂ ਨਾ ਕੁਝ ਦਿਨ ਪਹਿਲਾਂ ਮੈਂ ਪੇਅਰੈਟਸ ਮੀਟਿੰਗ 'ਤੇ ਆ ਨਹੀਂ ਸਕਿਆ ਸਰ ਅਤੇ ਤਾਂ ਕਰਕੇ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਜੋ ਮੇਰੇ ਬੱਚੇ ਦਾ ਇੰਟਰਵਿਊ ਹੋਇਆ ਸੀ ਉਸ ਵਿੱਚ ਮੇਰਾ ਬੱਚਾ ਕਿਵੇਂ ਠੀਕ ਰਿਹਾ ਜੀ ਅੱਛਾ ਜੀ

ਅੱਛਾ ਉਹ ਮੈਂ ਸਰ ਤਾਂ ਕਰਕੇ ਨਾ ਮੈਂ ਤੁਹਾਡੀ ਮੀਟਿੰਗ 'ਤੇ ਪਹੁੰਚ ਨਹੀਂ ਨਾ ਸਕਿਆ ਮੈਂ ਕਿਹਾ ਚਲੋ ਕੋਲ ਕਰ ਲੈਂਦੇ ਹਾਂ ਮੈਂ ਤਾਂ ਕਰਕੇ ਕੋਲ ਤੁਹਾਨੂੰ ਕੀਤੀ ਸੀਗੀ ਹੋਰ ਬਾਕੀ ਟੈਸਟਾਂ 'ਚ ਕਿਵੇਂ ਠੀਕ ਹੈ ਜੀ ਹਾਂ ਚਲੋ ਕੋਈ ਗੱਲ ਨਹੀਂ ਸਰ ਬਾਕੀ ਦੇਖਦੇ ਹਾਂ ਸਰ ਟਾਇਮ ਕੱਢ ਕੇ ਆਵਾਂਗੇ ਸਕੂਲ ਦੇ ਵਿੱਚ ਜੀ ਹਾਂਜੀ ਹੋਰ ਸਰ ਕੋਈ ਹੋਰ ਕੋਈ ਗ਼ਲਤੀ ਗੁਲਤੀ ਜਾਂ ਕਿਸੇ ਬੱਚੇ ਨਾਲ਼ ਮਾਰ ਪੀਟ ਕੀਤੀ ਹੋਵੇ ਸਕੂਲ ਦੇ ਵਿੱਚ ਉਸ ਨੇ ਅੱਛਾ ਜੀ ਆਹੋ ਤਾਂ ਕਰਕੇ ਨਾ ਉਹ ਸ਼ਰਾਰਤਾਂ ਬਹੁਤ ਕਰਦਾ ਹੈ ਜੀ ਸਕੂਲ ਦੇ ਵਿੱਚ ਵੀ ਅਤੇ ਘਰਾਂ 'ਚ ਵੀ ਤਾਂ ਕਰਕੇ ਮੈਂ ਕਿਹਾ ਸ਼ਾਇਦ ਸਕੂਲ ਦੇ ਵਿੱਚ ਵੀ ਕੋਈ ਸ਼ਰਾਰਤ ਨਾ ਕੀਤੀ ਹੋਵੇ ਹਾਂਜੀ ਇਹ ਤਾਂ ਹੈਗਾ ਜੀ ਹੋਰ ਜੀ ਕੋਈ ਮਤਲਬ ਬਾਕੀ ਦੇਖਦੇ ਹੈ ਜੀ ਟਾਇਮ ਕੱਢ ਕੇ ਆਉਂਦੇ ਹਾਂ ਸਕੂਲ ਦੇ ਵਿੱਚ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਸਰ ਕੋਸ਼ਿਸ਼ ਕਰਾਂਗੇ ਜ਼ਰੂਰ ਤੁਸੀਂ ਜਿਵੇਂ ਵੀ ਕਿਹਾ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਸਟੱਡੀ ਕਰਵਾਉਣ ਦੀ ਅੱਛਾ ਜੀ ਚਲੋ ਕੋ ਚਲੋ ਕੋਈ ਗੱਲ ਨਹੀਂ ਸਰ ਦੇਖਦੇ ਹਾਂ ਉਹਨਾਂ ਦੀ ਟਿਊਸ਼ਨ ਦਾ ਵੀ ਇੰਤਜਾਮ ਕਰਦੇ ਹਾਂ ਲਾਉਂਦੇ ਹਾਂ ਥੋੜ੍ਹੀ ਜਿਹੀ ਨੌਲੇਜ਼ ਆ ਜੂਗੀ ਉਹਨੂੰ ਹੋਰ ਦੱਸੋ ਹੋਰ ਕੋਈ ਕੰਪਲੇਟ ਜੀ ਉਸਦੀ ਸਕੂਲ ਦੇ ਵਿੱਚ ਆਈ ਹੋਵੇ ਚੋ ਚਲੋ ਠੀਕ ਹੈ ਸਰ ਓਕੇ